ਹੈਲੋ ਹੈਲੋ ਹਾਂਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਪਛਾਣ ਲਿਆ ਜੀ ਨਹੀਂ ਮੈਂ ਨੰਬਰ ਨੁੰਬਰ ਨਹੀਂ ਹੁੰਦਾ ਜੀ ਤਾਂ ਕਰਕੇ ਮੈਂ ਕਿਹਾ ਚੱਲ ਪੁੱਛ ਲਈਏ ਹੋਰ ਕੀ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਜੀ ਹਾਂਜੀ ਕੀ ਬਣਦਾ ਪਿਆ ਜੀ ਇੱਕ ਮੈਂ ਗੱਲ ਕਰਨੀ ਤੁਹਾਡੇ ਨਾਲ ਜ਼ਰੂਰੀ ਉਹ ਆਪਣਾ ਇਥੇ ਗਲੀ ਆਪਣੀ ਕੋਈ ਵੀ ਬਾਹਲੀ ਖ਼ਰਾਬ ਜੀ ਅਤੇ ਪਾਣੀ ਪੂਣੀ ਖੜ੍ਹ ਜਾਂਦਾ ਮੀਂਹ ਆਉਂਦਾ ਉਦੋਂ ਅਤੇ ਬੁਰਾ ਹਾਲ ਹੋ ਜਾਂਦਾ ਜੀ ਇੱਕ ਤਾਂ ਸੀਵਰੇਜ ਦਾ ਬੁਰਾ ਹਾਲ ਅਤੇ ਉਹ ਆਪਣਾ ਇੱਥੇ ਇੰਟਰਲੋਕ ਟੈਲਾਂ ਵਾਲੀ ਗਲੀ ਬਣਾਉਣੀ ਹੈ ਜੀ ਹਾਂਜੀ ਹਾਂਜੀ ਅਤੇ ਉਹ ਆ ਤੁਸੀਂ ਤਾਂ ਕਹਿ ਦੋ ਸਾਰੇ ਘਰ ਇਕੱਠੇ ਹੋ ਬਾਕੀ ਹੋਣਗੇ ਤਾਂ ਹੀ ਆਉਣਾ ਜੀ

ਹਾਂਜੀ ਹਾਂ

ਹਾਂ ਉਹ ਤਾਂ ਕਰਕੇ ਨਾ ਹੁਣ ਤੱਕ ਦੀ ਗਲੀ ਘਰ 'ਚ ਗੱਡੀ ਹੋਈ ਪਈ ਆ ਨਾਲੇ ਤਾਂ ਖੁੱਲ੍ਹੀ ਹੋਜੂਗੀ ਵਧੀਆ ਗਲੀ ਬਣਜੁਗੀ ਨਾਲੇ ਸੋਹਣੀ ਬਣਜੂਗੀ ਜੀ ਹਾਂਜੀ ਹਾਂਜੀ ਅਤੇ ਉਹ ਆਇਆ ਗਿਆ ਕਹਿੰਦਾ ਠੀਕ ਆ ਗਲੀ ਵਧੀਆ ਬਣੀ ਹੈ ਨਾ ਜੀ ਅਤੇ ਉਹ ਤਾਂ ਕਰਕੇ ਕਹਿੰਦੇ ਸੀ ਵੀ ਆਪਾਂ ਇੰਟਰਲੋਕ ਟੈਲਾਂ ਵਾਲੀ ਲਵਾ ਲਈਏ ਫਿਰ ਗਲੀ ਮਿਸਤਰੀ ਮੁਸਤਰੀ ਲਾ ਕੇ ਸਾਰੇ ਘਰ ਪੈਸੇ ਪਾ ਲਈਏ ਅੱਛਾ ਜੀ ਤੁਹਾਡੇ ਵੀ ਮਿਸਤਰੀ ਹੈਗਾ ਤੁਹਾਡੀ ਨਿਗਾਹ 'ਚ ਕੋਈ ਨਹੀਂ ਬਾਈ ਨੂੰ ਪਤਾ ਹੋਉਗਾ ਕੋਈ ਗਲੀ ਗੁਲੀ ਦਾ ਮਿਸਤਰੀ ਮੁਸਤਰੀ ਦਾ ਅਤੇ ਉਹ ਫਿਰ ਉਸ ਹਿਸਾਬ ਨਾਲ ਐਸਟੀਮੇਟ ਬਣਾ ਕੇ ਦੱਸਣਾ ਇਹੀ ਸਾਰਿਆਂ ਨੂੰ ਪੈਸੇ ਪੂਹੇ ਕਿੰਨੇ ਪੈਂਦੇ ਕੀ ਹਿਸਾਬ ਕਿਤਾਬ ਆ ਹਾਂ ਗਲੀ ਵਾਲਿਆਂ ਨਾਲ ਤੁਸੀਂ ਗੱਲ ਕਰੋਗੇ ਕਿਸੇ ਨਾਲ ਗੱਲ ਹੀ ਗਲੀ ਜਾ ਤੁਸੀਂ ਗਲੀ 'ਚ ਗੱਲ ਕਰਿਓ ਕਿਸੇ ਨਾਲ ਫਿਰ ਆਢੀਆਂ ਗੁਆਂਢੀਆਂ ਕਿਸੇ ਨਾਲ ਹਾਂਜੀ ਚਲੋ ਠੀਕ ਹੈ ਵਧੀਆ ਕਰਵਾ ਦਿਓ ਫਿਰ ਗੱਲ ਕਰਕੇ ਦੱਸਿਓ ਮਾੜਾ ਜਿਹਾ ਜੀ ਠੀਕ ਹੈ ਜੀ